ਹੈਲੋ ਮੈਂ ਕੁਛ ਸਮਾਂ ਪਹਿਲਾਂ ਹੀ ਐਮਾਜ਼ੋਨ ਤੋਂ ਸ਼ੂਜ ਔਡਰ ਕਰੇ ਸੀ ਜਿਸਨੂੰ ਕਿ ਤੁਹਾਡਾ ਡਿਲੀਵਰੀ ਬੋ ਬੋਏ ਲੈ ਕੇ ਆਇਆ ਸੀ ਜੋ ਕਿ ਜਿਸਦਾ ਕਿ ਰਵੱਈਆ ਬਹੁਤ ਹੀ ਜ਼ਿਆਦਾ ਖਰਾਬ ਸੀ ਉਸਦੀ ਬੋਲਣ ਦਾ ਢੰਗ ਵੀ ਬਹੁਤ ਖਰਾਬ ਸੀ ਉਹ ਇੱਕ ਤਾਂ ਗੁੱਸੇ ਵਿੱਚ ਬੋਲ ਰਿਹਾ ਸੀ ਅਤੇ ਸਮੇਂ ਤੋਂ ਲੇਟ ਆਇਆ ਸੀਗਾ ਉਸਨੇ ਘੰਟੇ ਪਹਿਲਾਂ ਫ਼ੋਨ ਕੀਤਾ ਸੀ ਬਟ ਉਹ ਦੋ ਘੰਟੇ ਬਾਅਦ ਆਇਆ ਸੀ ਉਹ ਉਸਦੇ ਦੇਖਣ ਦਾ ਢੰਗ ਵੀ ਸਹੀ ਨਹੀਂ ਸੀ ਅਤੇ ਉਹ ਬਹੁਤ ਹੀ ਜ਼ਿਆਦਾ ਬਦਤਮੀਜ਼ੀ ਕਰ ਰਿਹਾ ਸੀ